ਪੰਜਾਬ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਦੀਵਾਲੀ ਈਦ ਕ੍ਰਿਸਮਿਸ ਵਿਸਾਖੀ ਦੀਵਾਲੀ ਵਾਲ਼ੇ ਦਿਨ ਪਹਿਲਾਂ ਅਸੀਂ ਕੁਝ ਦਿਨ ਪਹਿਲਾਂ ਸਫਾਈ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਲੋਕ ਪੇਂਟ ਵਗੈਰਾ ਵੀ ਕਰਵਾਉਂਦੇ ਹਨ ਅਤੇ ਚੰਗੀ ਤਰ੍ਹਾਂ ਸਫਾਈ ਕਰਦੇ ਹਨ ਅਤੇ ਅਤੇ ਫਿਰ ਅਸੀਂ ਦੀਵਾਲੀ ਵਾਲ਼ੇ ਦਿਨ ਪਹਿਲਾਂ ਮੱਥਾ ਟੇਕਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਭੋਜਨ ਵਗੈਰਾ ਖਾ ਖਾਇਆ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਫਿਰ ਰਾਤ ਫਿਰ ਪਟਾਕੇ ਵੀ ਚਲਾਏ ਜਾਂਦੇ ਹਨ ਜਿਸ ਨਾਲ਼ ਅਸਮਾਨ ਬਹੁਤ ਵਧੀਆ ਲੱਗਦਾ ਹੈ ਪਰ ਇਸ ਨਾਲ਼ ਪ੍ਰਦੂਸ਼ਣ ਵੀ ਬਹੁਤ ਬ ਬਹੁਤ ਹੁੰਦਾ ਹੈ ਅਤੇ ਸਾਡੀ ਸਿਹਤ ਨੂੰ ਬਹੁਤ ਖਰਾਬ ਕਰਦਾ ਹੈ ਅਤੇ ਵਿਸਾਖੀ ਵਿਸਾਖੀ ਵਾਲ਼ੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਉੱਥੇ ਬਹੁਤ ਵਧੀਆ ਮੇਲਾ ਲੱਗਦਾ ਹੈ ਇਸ ਦਿਨ ਕਿਸਾਨ ਭਾਈਚਾਰਾ ਨੇ ਭਾਈਚਾਰਾ ਨੇ ਆਪਣੇ ਜਿਵੇਂ ਕਿ ਝੋਨਾ ਕਣਕ ਉਹਨਾਂ ਦੀ ਵਢਾਈ ਕਰਦੇ ਹਨ ਅਤੇ ਉਹ ਬਹੁਤ ਖੁਸ਼ ਹੁੰਦੇ ਹਨ